ਵੈਸੇ ਜੇ ਭਾਰਤੀ ਪ੍ਰਵੇਸ਼ 'ਚ ਦੇਖੀਏ ਤਾਂ ਘੋੜੇ ਦੀਆਂ ਮੁਖਤ ਮਾਰਵਾੜੀ ਕਾਠੀਆਂਵਾੜੀ ਅਤੇ ਦੋਹੀ ਮੇਜਰ ਨਸਲਾਂ ਨਜ਼ਰ ਆਉਂਦੀਆਂ ਜਿਹੜੇ ਅਤੇ ਸਿੰਧੀ ਜਿਹੜਾ ਪੱਛਮੀ ਉਹ ਹਿੱਸਾ ਹੈ ਉਹਦੇ ਮਗਰੋਂ ਉਹਨਾਂ 'ਚੋਂ ਹੀ ਇਹ ਸਭ ਬਰਾਂਚਸ ਆਈਆਂ ਨੇ ਜਿਵੇਂ ਜਿਹਨੂੰ ਨੁਕਰਾ ਕਹਿੰਦੇ ਆ ਉਹੀ ਮਾਰਵਾੜੀ ਅਤੇ ਸਿੰਧੀ ਦਾ ਅੱਗੇ ਇਕ ਮਿਕਸ ਹੈ ਇੱਕ ਪਰਾਰੂਪ ਹੈ ਮੇਰੀ ਪਸੰਦੀਦਾ ਨਸਲ ਜੇ ਆਪਾਂ ਭਾਰਤੀਏ ਮਹਾਂਦੀਪ 'ਚ ਉਪ ਮਹਾਂਦੀਪ 'ਚ ਦੇਖੀਏ ਤਾਂ ਮੇਰੀ ਸਭ ਤੋਂ ਪਸੰਦੀਦਾ ਨਸਲ ਮਾਰਵਾੜੀ ਹੈ ਕਿਉਂਕਿ ਉਸ ਘੋੜੇ ਨੂੰ ਦੇਖਣ 'ਚ ਉਹਦੀ ਸੌਂਦਰੀ ਜਿਹੜੀ ਸ਼ਾਰੀਰਿਕ ਖ਼ੂਬਸੂਰਤੀ ਹੈ ਸੁੰਦਰਤਾ ਉਹਦੀ ਮਿਲੇ ਹੋਏ ਕੰਨ ਜਿਹੜੇ ਇੱਕ ਬੜੇ ਖੂਬਸੂਰਤ ਆਕਾਰ ਬਣਾਉਂਦੇ ਜਿਹੜੇ ਥਰੀ ਸਿਕਸਟੀ ਡਿਗਰੀ ਜਿਹੜੀ ਚਾਰੋ ਚੁਫੇਰੇ ਫਿਰ ਜਾਂਦੇ ਆ ਅਤੇ ਉਹਦੀ ਜਿਹੜੀ ਬਨਾਵਟ ਹੈ ਜਿਹੜਾ ਤੋਤੇ ਵਰਗਾ ਉਹਦਾ ਨੱਕ ਹੈ ਅਤੇ ਉਹਦਾ ਰੰਗੋ ਰੂਪ ਹੈ ਰੰਗਤ ਉਹ ਬੜੀ ਖ਼ੂਬਸੂਰਤ ਹੈ ਅਤੇ ਉਹ ਚੱਲਣ 'ਚ ਵੀ ਬੜਾ ਤੇਜ਼ ਹੁੰਦਾ ਹੈ ਅਤੇ ਉਹ ਬੜਾ ਵਫ਼ਾਦਾਰ ਨਸਲ ਦੀ ਮਾਰਵਾੜੀ ਜਿਹੜੀ ਨਸਲ ਬੜੀ ਵਫ਼ਾਦਾਰ ਨਸਲ ਹੁੰਦੀ ਮਾਰਵਾੜੀ ਨਾਂ ਅਸਲ 'ਚ ਮਾਰਵਾੜਨ ਨਾਂ ਦਾ ਜਿਹੜਾ ਛੇਤਰ ਹੈ ਰਾਜਸਥਾਨ ਅਤੇ ਜਿਹੜਾ ਪਾਲੀ ਅਤੇ ਜੋਧਪੁਰ ਦੇ ਵਿਚਾਲੇ ਮਾਰਵਾੜ ਦਾ ਮਤਲਬ ਹੈ ਮਰੂਦਾ ਜਿਹੜੀ ਮ੍ਰਿਤ ਧਰਤੀ ਹੈ ਜਿੱਥੇ ਮੌਤ ਸੀ ਉਸ ਧਰਤ ਤੋਂ ਜਨਮਿਆ ਹੈ ਘੋੜੇ ਦੀ ਨਸਲ ਮਾਰਵਾੜੀ ਅਤੇ ਭਾਰਤੀ ਪਰਵਿਸ਼ ਦੇਖੀਏ ਤਾਂ ਮੈਨੂੰ ਮਾਰਵਾੜੀ ਨਸਲ ਬੜੀ ਪਸੰਦ ਏ ਕਿਉਂਕਿ ਉਹਦੀ ਚਾਰਲਿਕਤਕ ਜੋ ਜਿਹੜੀ ਵਿਸ਼ੇਸ਼ਤਾ ਹੈ ਮਾਲਕ ਦੇ ਪ੍ਰਤੀ ਉਹਦੀ ਵਫ਼ਾਦਾਰੀ ਹੈ ਅਤੇ ਰਾਈਡਿੰਗ 'ਚ ਜਿਹੜਾ ਉਹ ਉਹ ਕਿੰਨਾ ਵਧੀਆ ਘੋੜਾ ਹੈ ਅਤੇ ਉਹਦੀ ਚਾਲ ਹੈ ਸਾ ਸਾਰੇ ਫੀਚਰਸ ਕਰਕੇ ਇਹ ਸਾਰੇ ਖ਼ੂਬੀਆਂ ਕਰਕੇ ਉਹ ਘੋੜਾ ਮੈਨੂੰ ਬੜਾ ਪਸੰਦ ਹੈ ਜੇ ਆਪਾਂ ਵੈਸ਼ਵਿਕ ਪੱਧਰ 'ਤੇ ਦੇਖੀਏ ਤਾਂ ਮੇਰੀ ਸਭ ਤੋਂ ਪਸੰਦੀਦਾ ਨਸਲ ਅਰੇਬੀਅਨ ਨਸਲ ਅਰਬੀ ਨਸਲ ਜਿਹਦੀ ਬਨਾਵਟ ਬੜੀ ਛੋਟੀ ਅਤੇ ਉਹਦੀ ਜਿਹੜੇ ਨਸਤੂਰੇ ਹੈ ਜਿਹੜੇ ਨੱਕ ਦੀ ਨਸਥੂਣੀਆਂ ਛਦਰਾ ਹੁੰਦੀਆਂ ਉਹ ਵੱਡੀਆਂ ਹੁੰਦੀਆਂ ਅਤੇ ਉਹ ਮਾਰੂਥਲ ਦਾ ਇੱਕ ਜੀਅ ਉਹ ਛੋਟੀ ਬਨਾਵਟ ਦੇ ਬਾਵਜੂਦ ਵੀ ਬੜਾ ਮਜ਼ਬੂਤ ਘੋੜਾ ਹੈ ਅਤੇ ਬੜੀ ਤੇਜ਼ੀ ਨਾਲ ਦੌੜਦਾ ਹੈ ਅਰਬੀ ਘੋੜਾ ਪਸੰਲ ਪਸੰਦ ਹੋਣ ਦਾ ਮੇਰਾ ਸਭ ਤੋਂ ਵੱਡਾ ਕਾਰਨ ਉਹਦੀ ਸਪੀਡ ਅਤੇ ਉਹਦੀ ਜਿਹੜੀ ਸ਼ਮਤਾ ਹੈ ਅਤੇ ਉਹਦੀ ਜਿਹੜੀ ਭਾਰ ਵਾਹਕ ਸ਼ਮਤਾ ਹੈ ਅਤੇ ਉਹਦੀ ਰੈਜ਼ੀਲੀਅੰਸ ਹੈ ਜਿਹਨੂੰ ਆਪਾਂ ਕਹਿੰਦੇ ਪ੍ਰਤੀਰੋਧਕ ਸ਼ਮਤਾ ਉਹ ਬੜੀ ਤੇਜ਼ ਹੈ ਤਾਂ ਕਰਕੇ ਮੈਨੂੰ ਉਹ ਘੋੜਾ ਬੜਾ ਪਸੰਦ ਹੈ